ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਜੀ ਬ ਬਰਨਾਲੇ ਸ਼ਹਿਰ ਦੇ ਵਿੱਚ ਨਵਾਂ ਰਹਿਣ ਆਇਆ ਜੀ ਤੁਹਾਡੇ ਗੁਆਂਢ 'ਚ ਹਾਂਜੀ ਮੈਂ ਨਾ ਜੀ ਜਾਣਕਾਰੀ ਲੈਣੀ ਸੀ ਥੋਤੋਂ ਕੁਛ ਹਾਂਜੀ ਮੈਨੂੰ ਨਾ ਜੀ ਦੁੱਧ ਚਾਹੀਦਾ ਹੁੰਦਾ ਸਵੇਰੇ ਹਾਂਜੀ ਓਕੇ ਜੀ ਹਾਂਜੀ ਓਕੇ ਜੀ ਠੀਕ ਹੈ ਜੀ ਹਾਂਜੀ ਪਨੀਰ ਵੀ ਮਿਲ ਜਾਂਦਾ ਜੀ ਓਕੇ ਜੀ ਹਾਂਜੀ ਮੈਨੂੰ ਰੇਟ ਬਾਰੇ ਮੈਨੂੰ ਰੇਟ ਬਾਰੇ ਪਤਾ ਲੱਗ ਜੂ ਵੀ ਤੁਹਾਡੇ ਕੋਲੋਂ ਵੀ

ਠੀਕ ਹੈ ਜੀ ਅਤੇ ਮੈਨੂੰ ਨਾ ਜੀ ਖੋਆ ਕੱਢਣ ਵਾਸਤੇ ਦੁੱਧ ਚਾਹੀਦਾ ਸੀਗਾ ਇਹਨਾਂ ਕੋਲੋਂ ਵੀ ਵਧੀਆ ਮਿਲ ਜੂਗਾ ਜੀ ਆਪਾਂ ਨੂੰ ਵੀ ਕੁਆਲਿਟੀ ਦਾ ਹਾਂਜੀ ਓਕੇ ਜੀ ਓਕੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਨਾ ਜੀ ਬਸ ਗਵਾਂਢ 'ਚ ਹੀ ਰਹਿਣ ਆਇਆ ਸੀਗਾ ਨਵਾਂ ਹੀ ਰਹਿਣ ਆਇਆ ਬਰਨਾਲੇ ਸ਼ਹਿਰ ਦੇ ਵਿੱਚ ਹਾਂਜੀ ਮੈਨੂੰ ਹਾਂਜੀ ਜੀ ਮੈਨੂੰ ਪਤਾ ਲੱਗਿਆ ਸੀ ਵੀ ਤੁਸੀਂ ਲਿਆਉਂਦੇ ਜੀ ਦੁੱਧ ਡੈਰੀ 'ਚੋਂ ਹਾਂ ਠੀਕ ਹੈ ਜੀ ਓਕੇ ਹਾਂਜੀ ਬਸ ਆਹੀ ਪੁੱਛਣਾ ਸੀਗਾ ਵੀ ਥੋਤੋਂ ਮਿਲਾਵਟ ਤਾਂ ਨਹੀਂ ਵੀ ਕਈ ਵਾਰ ਹੈ ਨਾ ਜੀ ਆਪਾਂ ਨੂੰ ਵਧੀਆ ਚੀਜ਼ ਚਾਹੀਦੀ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜਿਵੇਂ ਕਿ ਸਾਨੂੰ ਦੁੱਧ ਚਾਹੀਦਾ ਹੁੰਦਾ ਹੈਗਾ ਦਹੀਂ ਵੀ ਚਾਹੀਦਾ ਹੁੰਦਾ ਸਵੇਰੇ ਸਵੇਰੇ ਜੀ ਠੀਕ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਜਿਵੇਂ ਸਾਨੂੰ ਦੇਸੀ ਘਿਓ ਚਾਹੀਦਾ ਹੁੰਦਾ ਵੀ ਸਵੇਰੇ ਸਵੇਰੇ ਹੈ ਨਾ ਜੀ ਹਾਂ ਵੀ ਸਾਨੂੰ ਕੋਈ ਮਿਲਾਵਟ ਵਾਲੀ ਚੀਜ਼ ਨਾ ਮਿਲੇ ਜੀ ਸਾਨੂੰ ਓਕੇ ਜੀ

ਓਕੇ ਜੀ ਓਕੇ ਠੀਕ ਹੈ ਜੀ ਫਿਰ ਅਸੀਂ ਸਵੇਰੇ ਕਰਦੇ ਹਾਂ ਜੀ ਪਤਾ ਓਕੇ ਜੀ ਧੰਨਵਾਦ ਧੰਨਵਾਦ ਠੀਕ ਹੈ